ਸਤਿ ਸ਼੍ਰੀ ਅਕਾਲ ਜੀ ਤੁਸੀਂ ਦਾਣਾ ਪਾਣੀ ਖਰੜ ਤੋਂ ਬੋਲ ਰਹੇ ਹੋ ਮੈਂ ਇੱਕ ਪੀਜ਼ਾ ਲਾਰਜ ਸਾਈਜ਼ ਪੀਜ਼ਾ ਦੋ ਬਰਗਰ ਇੱਕ ਡੋਸਾ ਸ਼ਾਹੀ ਪਨੀਰ ਦਾਲ਼ ਮੱਖਣੀ ਅਤੇ ਰਸ ਮਲਾਈ ਔਡਰ ਕਰਨੀ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕੈਸ਼ ਔਨ ਪੇਮੈਂਟ ਹੋਵੇਗੀ ਜਾਂ ਪੇਟੀਐਮ ਕੀਤਾ ਜਾਵੇਗਾ ਮੈਂ ਇੱਕ ਸੌ ਨੌ ਨੰਬ ਹਾਊਸ ਨੰਬਰ ਖਰੜ ਮੋਹਾਲੀ ਦੀ ਰਹਿਣ ਵਾਲੀ ਹਾਂ ਕਿਆ ਇਸ ਐਡਰੈੱਸ 'ਤੇ ਤੁਸੀਂ ਮੈਨੂੰ ਔਨਲਾਈਨ ਡਿਲੀਵਰ ਕਰ ਸਕਦੇ ਹੋ